ਸਾਡੇ ਪੰਜਾਬ ਦੇ ਸਾਹਿਤਕਾਰਾਂ ਨੇ ਵੀ ਪੰਜਾਬੀ ਨੂੰ ਬਹੁਤ ਪ੍ਰਮੋਟ ਕੀਤਾ ਹੈ ਅਤੇ ਜਿਹੜਾ ਆਪਣਾ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਇਸੇ ਲਈ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਤਰ੍ਹਾਂ ਤਰ੍ਹਾਂ ਦੇ ਰੀਤੀ ਰਿਵਾਜ ਅਤੇ ਤਿਉਹਾਰ ਮਨਾਏ ਜਾਂਦੇ ਹਨ ਜਿਵੇਂ ਕਿ ਵਿਸਾਖੀ ਦਾ ਦਿਹਾੜਾ ਹੋ ਗਿਆ ਗੁਰਪੁਰਬ ਹੋ ਗਏ ਗਿੱਧਾ ਅਤੇ ਤੀਜਾਂ ਇੱਦਾਂ ਦਾ ਤਿਉ ਤੀਜ ਦਾ ਤਿਉਹਾਰ ਹੋ ਗਿਆ ਬਹੁਤ ਹੀ ਚਾਵਾਂ ਨਾਲ ਮਨਾਇਆ ਜਾਂਦਾ ਹੈ ਜਿਹੜੇ ਕਿ ਪੰਜਾਬੀ ਭਾਸ਼ਾ ਸਾਡੀ ਇਸੇ ਕਰਕੇ ਬਹੁਤ ਤਰੱਕੀ 'ਤੇ ਹੈ ਅਤੇ ਸਾਡੇ ਸੱਭਿਆਚਾਰ ਨੂੰ ਅੱਗੇ ਲਿਆਉਣ 'ਚ ਪੰਜਾਬੀ ਭਾਸ਼ਾ ਦਾ ਬਹੁਤ ਹੀ ਯੋਗਦਾਨ ਹੈ ਅਤੇ ਹੁਣ ਤਾਂ ਕਨੇਡਾ ਵਿੱਚ ਵੀ ਇਸਨੂੰ ਦੂਜੀ ਭਾਸ਼ਾ ਹੋਣ ਦਾ ਮਾਨ ਪ੍ਰਾਪਤ ਹੋ ਗਿਆ ਹੈ ਕਨੇਡਾ ਵਿੱਚ ਹੁਣ ਪੰਜਾਬੀ ਜਿਹੜੀ ਹੈ ਦੂਜੀ ਭਾਸ਼ਾ ਦੇ ਨਾਮ ਨਾਲ ਜਾਣੀ ਜਾਂਦੀ ਹੈ ਅਤੇ ਉੱਥੇ ਪੰਜਾਬੀ ਪੰਜਾਬੀ ਰਹਿੰਦੇ ਹਨ ਜਿਹੜੇ ਬਹੁਤ ਹੀ ਖੁਸ਼ ਹਨ ਇਸ ਗੱਲ ਤੋਂ